ਮੇਰੇ ਸ਼ਹਿਰ ਪਟਿਆਲੇ ਵਿੱਚ ਬਹੁਤ ਹੀ ਜਿਆਦਾ ਸਰਕਾਰੀ ਹਸਪਤਾਲ ਹਨ ਜਿਸ ਵਿੱਚ ਰਜਿੰਦਰਾ ਅਤੇ ਮਾਤਾ ਕੌਸ਼ਲਿਆ ਮਸ਼ਹੂਰ ਹਸਪਤਾਲ ਹਨ ਕਿਉਂਕਿ ਇੱਥੇ ਕੋਈ ਵੀ ਵਿਅਕਤੀ ਆਪਣਾ ਇਲਾਜ ਘੱਟ ਪੈਸੇ ਉੱਤੇ ਕਰਵਾ ਸਕਦਾ ਹੈ ਅਤੇ ਨਾਲ ਹੀ ਨਾਲ ਇੱਥੇ ਆਯੁਸ਼ਮਾਨ ਕਾਰਡ ਦੀ ਵਰਤੋਂ ਕਰਕੇ ਵਿਅਕਤੀ ਆਪਣਾ ਟ੍ਰੀਟਮੈਂਟ ਫਰੀ ਵੀ ਕਰਵਾ ਸਕਦਾ ਹੈ ਅਤੇ ਇੱਥੇ ਘੱਟ ਰੇਟ 'ਤੇ ਦਵਾਈਆਂ ਵੀ ਮਿਲਦੀਆਂ ਹਨ ਇਸ ਤੋਂ ਇਲਾਵਾ ਇੱਥੇ ਕਿਸੇ ਵੀ ਵਿਅਕਤੀ ਨੂੰ ਪਾਰਕਿੰਗ ਦੀ ਕੋਈ ਵੀ ਫੀਸ ਨਹੀਂ ਭਰਨੀ ਪੈਂਦੀ ਪਰ ਇੱਥੇ ਸਫਾਈ ਪੂਰੀ ਤਰ੍ਹਾਂ ਨਹੀਂ ਹੁੰਦੀ ਅਤੇ ਇੱਕ ਪਾਸੇ ਪ੍ਰਾਈਵੇਟ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਾਈਵੇਟ ਹਸਪਤਾਲ ਚੌਵੀ ਘੰਟੇ ਖੁੱਲ੍ਹੇ ਹੁੰਦੇ ਹਨ ਇੱਥੇ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ ਅਤੇ ਨਾਲ ਹੀ ਨਾਲ ਇੱਥੇ ਮਰੀਜ਼ ਨੂੰ ਵਧੀਆ ਸੁਵਿਧਾ ਦਿੱਤੀਆਂ ਜਾਂਦੀਆਂ ਹਨ ਪਰ ਇਸ ਦਾ ਖਰਚਾ ਸਰਕਾਰੀ ਹਸਪਤਾਲਾਂ ਨਾਲੋਂ ਬਹੁਤ ਹੀ ਜ਼ਿਆਦਾ ਹੈ ਅਤੇ ਜਿਸ ਕਾਰਨ

ਜਿਸ ਕਾਰਨ ਮਰੀਜ਼ਾਂ ਨੂੰ ਬੈਂਕ ਵੱਲੋਂ ਪੈਸਾ ਵੀ ਉਧਾਰ ਲੈਣਾ ਪੈਂਦਾ ਹੈ ਅਤੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਪਾਰਕਿੰਗ ਦੀ ਵੀ ਫੀਸ ਹੁੰਦੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਹੁੰਦੀ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਜ਼ਿਆਦਾਤਰ ਲੋਕ ਆਈ ਸੀ ਯੂ ਵਿੱਚ ਜਾਣ ਤੋਂ ਡਰਦੇ ਹਨ ਕਿਉਂਕਿ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਦੀ ਦਾ ਖਰਚਾ ਬਹੁਤ ਹੀ ਜ਼ਿਆਦਾ ਹੁੰਦਾ ਹੈ ਜੋ ਕਿ ਉਹਨਾਂ ਤੋਂ ਉਹਨਾਂ ਦੇ ਸਮਰਥ ਨੇ